ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਤੁਸੀਂ ਕੀ ਬੋਲ ਰਹੇ ਸੀ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਸਰ ਜ਼ਰੂਰ ਜਿਵੇਂ ਕਿ ਸਰ ਤੁਹਾਨੂੰ ਪਤਾ ਹੀ ਆ ਫਤਿਹਗੜ੍ਹ ਸਾਹਿਬ ਦੀ ਧਰਤੀ ਸਾਰੀ ਦੁਨੀਆ ਤੋਂ ਮਹਿੰਗੀ ਧਰਤੀ ਆ ਇੱਥੇ ਆਪਣੇ ਛੋਟੇ ਸਾਹਿਬਜ਼ਾਦੇ ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਸੀ ਉਹਨਾਂ ਦੀ ਸ਼ਹਾਦਤ ਹੋਈ ਸੀ ਜਿਸ ਦੀ ਯਾਦ ਵਿੱਚ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਬਣਿਆ ਹੋਇਆ ਅਤੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵੀ ਇੱਥੇ ਸੁਸ਼ੋਭਿਤ ਹੈ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਬਾਕੀ ਫਤਿਹਗੜ੍ਹ ਸਾਹਿਬ ਦੇ ਵਿੱਚ ਇਸ ਤੋਂ ਇਲਾਵਾ ਜਿੱਦਾਂ ਦੀਵਾਨ ਟੋਡਰ ਮੱਲ ਦੀ ਹਵੇਲੀ ਵੀ ਆ ਦੀਵਾਨ ਟੋਡਰ ਮੱਲ ਹਾਲ ਵੀ ਬਣਿਆ ਹੋਇਆ ਹੈ ਅਤੇ ਬਾਕੀ ਸ਼ਹਿਰ ਦੇ ਵਿੱਚ ਹੋਰ ਵੀ ਕਾਫੀ ਘੁੰਮਣ ਯੋਗ ਜਗ੍ਹਾ ਹਨ ਜਿੱਦਾਂ ਕਿ ਆਮ ਖਾਸ ਬਾਗ ਆ ਜੋ ਕਿ ਇੱਕ ਰਾਜੇ ਨੇ ਬਣਾਇਆ ਸੀਗਾ ਅਤੇ ਉੱਥੇ ਉਹ ਸੈਲਾਨੀਆਂ ਲਈ ਕਾਫੀ ਇੱਕ ਖਿੱਚ ਦਾ ਕੇਂਦਰ ਆ ਬਾਕੀ ਜੇ ਆਪਾਂ ਮੌਸਮ ਦੀ ਗੱਲ ਕਰੀਏ ਤਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਇਸ ਸਮੇਂ ਬਾਰਿਸ਼ ਹੋ ਰਹੀ ਆ ਅਤੇ ਧੁੰਦ ਦਾ ਮੌਸਮ ਥੋੜ੍ਹਾ ਜਿਹਾ ਸਟਾਰਟ ਹੋ ਗਿਆ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਧੁੰਦ ਹੋ ਜਾਂਦੀ ਆ ਕਿਉਂਕਿ ਸ਼ਹਾਦਤ ਦੇ ਦਿਨਾਂ ਦੇ ਵਿੱਚ ਇੱਥੇ ਪੋਹ ਦੇ ਮਹੀਨੇ ਵਿੱਚ ਕਾਫੀ ਜ਼ਿਆਦਾ ਠੰਡ ਹੋ ਜਾਂਦੀ ਹੈ ਅਤੇ ਤੁਸੀਂ ਆਪਣੇ ਕੱਪੜੇ ਵਗੈਰਾ ਉਸ ਹਿਸਾਬ ਨਾਲ ਹੈ ਨਾ ਲੈ ਕੇ ਆਇਓ ਕਿਉਂਕਿ ਅੰਮ੍ਰਿਤਸਰ ਦੇ ਮੁਕਾਬਲੇ ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਆਪਣੇ ਕਾਫੀ ਜ਼ਿਆਦਾ ਠੰਡ ਹੋਵੇਗੀ ਅਤੇ ਬਾਕੀ ਕੋਈ ਦਿੱਕਤ ਨਹੀਂ ਤੁਸੀਂ ਮੈਨੂੰ ਆਪਣਾ ਸਾਰਾ ਸ਼ੈਡਿਊਲ ਭੇਜ ਦਿਉ ਹੈ ਨਾ ਤੁਸੀਂ ਕਿਹੜੀ ਡੇਟ ਨੂੰ ਆ ਰਹੇ ਹੋ ਅਤੇ ਕਿੰਨੇ ਵਜੇ ਤੁਸੀਂ ਇੱਥੇ ਪਹੁੰਚੋਂਗੇ ਅਤੇ ਮੈਂ ਉੱਥੇ ਤੁਹਾਨੂੰ ਪਿਕਅਪ ਕਰ ਲਵਾਂਗੇ ਤੁਸੀਂ ਬਾਏ ਬੱਸ ਆ ਰਹੇ ਹੋ ਸਰ ਜਾਂ ਬਾਏ ਟਰੇਨ ਆ ਰਹੇ ਹੋ ਹਾਂਜੀ ਹਾਂਜੀ ਸਰ ਕੋਈ ਗੱਲ ਨਹੀਂ ਤੁਸੀਂ ਮੈਨੂੰ ਮੈਸੇਜ ਡਰੋਪ ਕਰ ਦਿਉ ਅਤੇ ਸਾਰਾ ਸ਼ਡਿਊਲ ਸਰ ਤੁਸੀਂ ਮੈਨੂੰ ਭੇਜ ਦਿਉ ਚਲੋ ਠੀਕ ਹੈ ਸਰ ਓਕੇ ਫਿਰ ਮਿਲਦੇ ਹਾਂ ਆਪਾਂ ਓਕੇ